ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਣੇ ਧਰਮ ਬਾਰੇ ਦੱਸਦੇ ਹਾਂ ਉਹਨਾਂ ਬਾਰੇ ਪ੍ਰੇਰਿਤ ਕਰਦੇ ਹਾਂ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਪਾਠ ਸਿਖਾਇਆ ਜਾਂਦਾ ਹੈ ਆਪਣੇ ਧਰਮ ਬਾਰੇ ਦੱਸਿਆ ਜਾਂਦਾ ਹੈ ਫਿਰ ਉਹ ਹੌਲੀ ਹੌਲੀ ਉਸ 'ਤੇ ਅਮਲ ਕਰਦੇ ਆ ਉਹਨੂੰ ਪੜ੍ਹਦੇ ਆ ਅਤੇ ਫਿਰ ਮਤਲਬ ਕਿ ਉਹਨਾਂ ਬਾਰੇ ਸਿੱਖ ਜਾਂਦੇ ਆ ਤਾਂ ਛੋਟੀ ਉਮਰ 'ਚ ਹੀ ਬੱਚਿਆਂ ਨੂੰ ਪਾਠ ਬਾਰੇ ਆਪਣੇ ਆਪਣੇ ਪਾਠ ਬਾਰੇ ਆਪਣੇ ਧਰਮ ਬਾਰੇ ਦੱਸਿਆ ਜਾਂਦਾ ਹੈ